ਹਾਂਜੀ ਸੋ ਮੈਂ ਰੋਪੜ ਸਿਟੀ ਤੋਂ ਬੀਲੋਂਗ ਕਰਦਾ ਹੈ ਸ਼ਹਿਰ ਤੋਂ ਬੀਲੋਂਗ ਕਰਦਾ ਹੈ ਸੋ ਯੈਸ ਇੱਥੇ ਫਸੀ ਕਾਫੀ ਅੱਛੀ ਸਹੂਲਤਾਂ ਹਨ ਦੋ ਤਰ੍ਹਾਂ ਦੇ ਟਰਾਂਸਪੋਰਟ ਐਂਡ ਪਬਲਿਕ ਅਤੇ ਪ੍ਰਾਈਵੇਟ ਸੋ ਪਬਲਿਕ ਵਾ ਜਿੱਦਾਂ ਬੱਸਾਂ ਹੋਗੀਆਂ ਰਿਕਸ਼ੇ ਟੈਂਪੂ ਟੈਕਸਿਸ ਕੈਬ ਆਈ ਥਿੰਕ ਕਾਫੀ ਅੱਛੀ ਹੈ ਸੋ ਪੀਪਲ ਜਿਹੜੇ ਲੋਕ ਹੈ ਅੱਛੀ ਤਰ੍ਹਾਂ ਟਰੈਵਲ ਕਰ ਸਕਦੇ ਹੈ ਡੇਲੀ ਜਿੱਥੇ ਉਹਨਾਂ ਨੇ ਆਪਣੇ ਕੰਮਾਂ 'ਤੇ ਜਾਣਾ ਜਾਂ ਕਾਰਾਂ 'ਤੇ ਜਾਣਾ ਹੈ ਔਰ ਇਸ ਤੋਂ ਇਲਾਵਾ ਲੋਕ ਜਿਹੜੇ ਆਪਣੇ ਜਿਹੜੇ ਵਾਹਨ ਹੈ ਉਹ ਵੀ ਯੂ ਯੂਜ਼ ਕਰਦੇ ਹੈ ਕਿਉਂਕਿ ਉਹਨਾ 'ਚ ਜ਼ਿਆਦਾ ਕਮਫਰਟ ਰਹਿੰਦੇ ਆ ਬਟ ਫੋਰ ਲੋਂਗ ਡੀਸਟੈਂਸ ਯੈਸ ਇੱਥੇ ਰੇਲਵੇ ਸਟੇਸ਼ਨ ਹੈ ਬੱਸਿਸ ਹੈ ਹਰ ਇੱਕ ਦੋ ਮਿੰਟ ਤੋਂ ਬਾਅਦ ਬੱਸਿਸ ਮਿਲ ਜਾਦੀਆਂ ਫਿਰ ਨਾਲ ਹੀ ਏਅਰਪੋਰਟ ਹੈ ਫੋਰਟੀ ਕਿਲੋਮੀਟਰ ਦੂਰ ਹੈ ਸ਼ਹਿਰ ਤੋਂ ਸੋ ਆਈ ਮੈਂ ਕਵਾਂਗਾ ਹਾਂ ਯੈੱਸ ਬਹੁਤ ਅੱਛੀ ਫੇਸੀਲਟੀਜ਼ ਹੈ ਜਿਹੜੀਆਂ ਟਰਾਂਸਪੋਰਟ ਦੀਆਂ ਸਾਡੇ ਸ਼ਹਿਰ ਵਿੱਚ ਐਂਡ ਲੋਕ ਈਂਜੋਏ ਕਰਦੇ ਹੈ ਜਿੱਦਾਂ ਉਹਨਾਂ ਨੂੰ ਕਮਫਰਟ ਲੱਗਦਾ ਹੈ ਅਗਰ ਅਗਰ ਕਮਫਰਟ ਲੱਗਦਾ ਹੈ ਤਾਂ ਦੇ ਆਪਣਾ ਪ੍ਰਾਈਵੇਟ ਵਹੀਕਲ ਯੂਸ ਕਰਦੇ ਹੈ ਨਹੀਂ ਤਾਂ ਪ੍ਰਾਈਵੇਟ ਵਹੀਕਲ